ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਓਨਰ ਬੋਲ ਰਿਹਾ ਉੱਥੇ ਦਾ ਦੱਸੋ ਓਕੇ ਜੀ ਕਿਹੜੀ ਕਲਾਸ 'ਚ ਹੈ ਬੱਚਾ ਓਕੇ ਠੀਕ ਹੈ ਜੀ ਹਾਂਜੀ ਕੋਈ ਨਾ ਮੈਮ ਤੁਸੀਂ ਭੇਜ ਦਿਓ ਅਤੇ ਬੈਸਟ ਟਾਈਮਿੰਗਸ ਅਤੇ ਤੁਹਾਨੂੰ ਫੀ ਸਟਕਚਰ ਮੈਂ ਦੱਸ ਦਿੰਦਾ ਹਾਂ ਬੈਸਟ ਟਾਈਮਿੰਗਸ ਮੈਮ ਆਪਣੇ ਕੋਲ ਇੱਕ ਆਫਟਰਨੂਨ ਵਾਲੀ ਹੈਗੀ ਆ ਵੰਨ ਟੂ ਥ੍ਰੀ ਪੀ ਐੱਮ ਅਤੇ ਅਗਰ ਪੀ ਹਾਂਜੀ ਮੈਮ ਤਕਰੀਬਨ ਸਾਰੇ ਬੱਚਿਆਂ ਨਾਲ ਪ੍ਰੋਬਲਮ ਫੇਸ ਕਰ ਰਿਹਾ ਅੱਜ ਕੱਲ੍ਹ ਹੈ ਨਾ ਹਾਂਜੀ ਹਾਂਜੀ ਇਵਨਿੰਗ ਬੈਚ ਮੈਮ ਹੈਗਾ ਜੇ ਫਾਈਵ ਟੂ ਸਿਕਸ ਥਰਟੀ ਜਿਹਦੇ ਵਿੱਚ ਕਿ ਮੇਰੀ ਫੀਮੇਲ ਪਰਸਨਲ ਟਰੇਨਰ ਹੈਗੀ ਆ ਉਹ ਜਿਹੜੀ ਕਿ ਤੁਹਾਡੇ ਬੱਚਿਆਂ ਨੂੰ ਆਰਾਮ ਨਾਲ ਵਧੀਆ ਤਰੀਕੇ ਨਾਲ ਸਿਖਾਏਗੀ ਸਾਰਾ ਅਤੇ ਤੁਹਾਨੂੰ ਅਸੀਂ ਉਹਦੀ ਡਾਇਟ ਪਲਾਨ ਵਗੈਰਾ ਵੀ ਦੱਸਾਂਗੇ ਤੁਸੀਂ ਉਹ ਫੋਲੋ ਕਰਵਾਉਣਾ ਉਹਨੂੰ ਉਹਦੇ ਨਾਲ ਉਹਦੀ ਹੈਲਥ ਜਿਹੜੀ ਆ ਕੋਨਸ਼ੀਅਸ਼ ਰਹੇਗੀ ਥੋੜ੍ਹੀ ਵਧੀਆ ਰਹੇਗਾ ਹਾਂਜੀ ਹਾਂਜੀ ਹਾਂਜੀ ਅਤੇ ਫੀਸ ਸਟਕਚਰ ਮੈਮ ਟੂ ਥਾਊਂਸੈਂਡ ਪਰ ਮੰਨਥ ਹੈ ਅਗਰ ਤੁਸੀਂ ਥਰੀ ਮੰਨਥਸ ਦਾ ਪੈਕਜ ਲੈਂਦੇ ਹੋ ਤਾਂ ਤੁਹਾਨੂੰ ਫਾਈਵ ਥਾਊਸੈਂਡ ਦਾ ਪੈਣਾ ਏ ਆ ਹਾਂਜੀ ਕੋਈ ਗੱਲ ਨਹੀਂ ਮੈਮ ਠੀਕ ਹੈ ਜੀ